ਕੋਵਿਡ ਲੋਕਡਾਉਨ ਦੌਰਾਨ ਮੋਬਾਈਲਾਂ ਦਾ ਬੱਚਿਆਂ ਨੇ ਪੜ੍ਹਾਈ ਵਿੱਚ ਬਹੁਤ ਮਦਦ ਮਿਲੀ ਹੈ ਕਿ ਘਰ ਬੈਠੇ ਬੱਚਿਆਂ ਨੇ ਪੜ੍ਹਾਈ ਕੀਤੀ ਹੈ ਉਹਦੇ ਤੋਂ ਬੱਚਿਆਂ ਨੂੰ ਵੀ ਚਲੋ ਆਪਦਾ ਪੜ੍ਹਾਈ ਨਹੀਂ ਭੁੱਲੇ ਬਹੁਤ ਜ਼ਿਆਦਾ ਫਾਇਦਾ ਰਿਹਾ ਅਤੇ ਨੁਕਸਾਨ ਵੀ ਹੋਏ ਨੇ ਕਿ ਬੱਚੇ ਪੜ੍ਹਦੇ ਵੀ ਸੀ ਅਤੇ ਘੱਟ ਪੜ੍ਹਦੇ ਸੀ ਵਿੱਚ ਦੀ ਫੋਨ ਚਲਾਉਂਦੇ ਸੀਗੇ ਫੋਨ ਚਲਾ ਚਲਾ ਕੇ ਬੱਚਿਆਂ ਦੇ ਕਈਆਂ ਦੇ ਅੱਖਾਂ 'ਤੇ ਚਸ਼ਮੇ ਵੀ ਚੜ੍ਹ ਗਏ ਨੇ ਨੁਕਸਾਨ ਵੀ ਹੋਏ ਨੇ ਉਦੋਂ ਦਾ ਹੀ ਬੱਚਿਆਂ ਨੂੰ ਇਹ ਜਿਹਾ ਲੋਕਡਾਊਨ ਦੇ ਵਿੱਚ ਬੱਚਿਆਂ ਨੇ ਫੋਨਾਂ ਤੋਂ ਜਿਹੜਾ ਛੂਹਿਆ ਵੀ ਜਿਹੜਾ ਉਹਨਾਂ ਨਾਲ ਖੇਡੇ ਆ ਇਹ ਜਿਹਾ ਉਹਨਾਂ ਨੂੰ ਮਤਲਬ ਸਿਸਟਮ ਬੈਠਿਆ ਨਾ ਉਹਨਾਂ ਦੇ ਦਿਮਾਗ 'ਚ ਵੀ ਉਹਨਾਂ ਨੂੰ ਇਹੀ ਹੁੰਦਾ ਵੀ ਹਾਂ ਵੀ ਫੋਨ ਹੀ ਮਿਲ ਜੇ ਅਸੀਂ ਖੇਡਦੇ ਰਹੀਏ ਖੇਡਦੇ ਰਹੀਏ ਅਸੀਂ ਤਾਂ ਉਹ ਗੇਮਾਂ ਕਦੇ ਦੇਖੀਆਂ ਵੀ ਨਹੀਂ ਸੀ ਜਿਹੜੇ ਅੱਜ ਕੱਲ੍ਹ ਬੱਚੇ ਮਿੰਟ 'ਚ ਚਲਾ ਲੈਂਦੇ ਨੇ ਮਤਲਬ ਇਹ ਕੁਛ ਉਸ ਦੌਰਾਨ ਦੇ ਨੁਕਸਾਨ ਵੀ ਨੇ ਅਤੇ ਫਾਇਦੇ ਵੀ ਹੋਏ ਸੀ ਸਾਨੂੰ ਫਾਇਦੇ ਇਹ ਹੋਏ ਸੀ ਕਿ ਅਸੀਂ ਘਰ ਬੈਠੇ ਕੋਈ ਚੀਜ਼ ਮੰਗਵਾਉਣੀ ਸੀ ਤਾਂ ਅਸੀਂ ਮ ਆਨਲਾਈਨ ਮੰਗਵਾ ਲੈਂਦੇ ਸੀ ਸਾਨੂੰ ਬਾਹਰ ਨਹੀਂ ਜਾਣਾ ਪੈਂਦਾ ਸੀ ਅਸੀਂ ਆਪਦੇ ਤੋਂ ਜਿਹੜੇ ਦੂਰ ਬੈਠੇ ਸੀ ਉਹਨਾਂ ਨਾਲ ਵੀਡੀਓ ਕਾਲ 'ਤੇ ਗੱਲਾਂ ਕਰ ਲੈਂਦੇ ਸੀ ਅੱਜ ਵੀ ਅਸੀਂ ਜਿਹੜੇ ਦੂਰ ਬੈਠੇ ਆ ਜਿਵੇਂ ਦੇਸ਼ਾਂ ਪਰਦੇਸਾਂ ਵਿੱਚ ਚਲੇ ਜਾਂਦੇ ਆ ਉਹਨਾਂ ਨਾਲ ਫੋਨਾਂ 'ਤੇ ਗੱਲ ਕਰ ਲੈਂਦੇ ਹਾਂ ਲੇਕਿਨ ਕੋਵਿਡ ਟਾਇਮ ਐਈਂ ਸੀ ਕਿ ਅਸੀਂ ਕਿਤੇ ਵੀ ਨਹੀਂ ਜਾ ਸਕਦੇ ਸੀ ਹੁਣ ਅਸੀਂ ਚਲੇ ਜਾਂਦੇ ਹਾਂ ਅਸੀਂ ਜਾ ਕੇ ਉੱਥੇ ਮਿਲ ਲੈਂਦੇ ਹਾਂ ਸਭ ਨੂੰ ਲੇਕਿਨ ਉਸ ਟਾਈਮ ਇਹ ਸੀ ਕਿ ਅਸੀਂ ਘਰੋਂ ਵੀ ਨਹੀਂ ਨਿਕਲ ਸਕਦੇ ਸੀਗੇ ਇਸ ਲਈ ਕੋਵਿਡ 'ਚ ਮਤਲਬ ਲੋਕਡਾਊਨ 'ਚ ਕਾਫੀ ਫਰਕ ਰਿਹਾ ਹੈਗਾ ਮੋਬਾਈਲਾਂ ਦਾ ਬੱਚਿਆਂ ਨੂੰ ਪੜ੍ਹਾਈ 'ਤੇ ਵੀ ਅਸਰ ਹੋਇਆ ਅਤੇ ਸਾਨੂੰ ਵੀ ਵੱਡਿਆਂ ਨੂੰ ਵੀ ਸ਼ੌਂਕ ਸੀ ਵੀ ਹਾਂ ਵੀ ਅਸੀਂ ਉਹਦੇ ਨਾਲ ਗੱਲ ਹੋ ਜੇ ਉਹਦੇ ਨਾਲ ਹੋ ਜੇ ਅਸੀਂ ਵੀਡੀਓ ਕਾਲ 'ਤੇ ਹੋ ਜਾਂਦੀ ਸੀ ਸਾਰੇ ਕੋਈ ਬਹੁਤ ਫਾਇਦੇ ਹੋਏ ਆ ਮਤਲਬ ਹਰ ਚੀਜ਼ ਦਾ ਫਾਇਦਾ ਨੁਕਸਾਨ ਤਾਂ ਤਾਂ ਉਹਨੇ ਨਾਲ ਨਾਲ ਹੀ ਹੁੰਦੇ ਨੇ ਇਸ ਲਈ ਫਾਇਦੇ ਵੀ ਸੀ ਅਤੇ ਨੁਕਸਾਨ ਵੀ ਸੀ